ਅੱਜ ਕੱਲ ਟੈਕਨੋਲੋਜੀ ਨੇ ਸਾਡੀ ਦੁਨੀਆਂ ਨੂੰ ਬਹੁਤ ਅੱਗੇ ਵਧਾਤਾ ਹੈ ਟੈਕਨੋਲਜੀ ਬਹੁਤ ਸਾਰੇ ਵਧੀਆ ਚੀਜਾਂ ਵੀ ਕਰਦੀਆਂ ਹਨ ਤੇ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਨੁਕਸਾਨ ਵੀ ਕੀਤਾ ਹੈ ਅੱਜ ਕੱਲ ਜਿੰਨਾ ਵੀ ਆਪਾਂ ਉਪਯੋਗ ਟੈਕਨੋਲੋਜੀ ਦਾ ਵਧੀਆ ਕਾਰਨ ਵਧੀਆ ਕੰਮਾਂ ਵਾਸਤੇ ਨਹੀਂ ਕਰਦੇ ਉਨਾ ਹੀ ਲੋਕ ਉਸ ਤੱਕ ਉਪਯੋਗ ਗਲਤ ਚੀਜ਼ਾਂ ਵਾਸਤੇ ਕਰ ਰਹੇ ਹਨ ਲੋਕਾਂ ਦੀ ਫੋਟੋ ਨੂੰ ਕਿਸੇ ਹੋਰ ਦਾ ਮੂੰਹ ਲਗਾ ਕੇ ਚੇਂਜ ਕੀਤਾ ਜਾ ਰਿਹਾ ਹੈ ਜੋ ਕੀ ਬਿਲਕੁਲ ਵੀ ਵਧੀਆ ਨਹੀਂ ਹੈਗਾ ਐ ਸਾਨੂੰ ਟੈਕਨੋਲੋਜੀ ਦਾ ਬਹੁਤ ਹੀ ਵਧੀਆ ਪ੍ਰਯੋਗ ਕਰਨਾ ਚਾਹੀਦਾ ਹੈ ਨਾ ਕੀ ਉਸ ਦਾ ਘਟੀਆ ਪ੍ਰਯੋਗ ਕਰਨਾ ਚਾਹੀਦਾ ਹੈ ਟੈਕਨੋਲੋਜੀ ਨੇ ਬਹੁਤ ਬਹੁਤ ਬਹੁਤ ਸਾਰੇ ਸੁਖ ਦਿੱਤੇ ਹਨ ਪੂਰੀ ਦੁਨੀਆ ਨੂੰ ਪਰੰਤੂ ਇਸਨੇ ਟੈਕਨੋਲਜੀ ਤੇ ਬਹੁਤ ਨੁਕਸਾਨ ਵੀ ਹੈਗੇ ਹਨ ਅੱਜ ਕੱਲ ਦੇ ਬੱਚੇ ਪੜਨ ਤੋਂ ਜਿਆਦਾ ਟੈਕਨੋਲੋਜੀ ਯੂਜ ਕਰਨ 'ਚ ਲੱਗੇ ਰਹਿੰਦੇ ਹਨ ਜਿਸਦਾ ਉਹਨਾਂ ਦਾ ਜਿਸ ਵਿੱਚ ਉਹਨਾਂ ਦਾ ਧਿਆਨ ਪੜਨ ਤੋਂ ਇਲਾਵਾ ਮੋਬਾਈਲ ਚਲਾਣ 'ਚ ਹੀ ਲੱਗਾ ਰਹਿੰਦਾ ਹੈ ਅੱਜ ਕੱਲ ਲੋਕੀ ਕਾਰੋਬਾਰ ਵੀ ਟੈਕਨੋਲਜੀ ਦੇ ਨਾਲ ਹੀ ਕਰ ਰਹੇ ਹਨ ਜੋ ਕਿ ਇੱਕ ਸੁਖਦਾਇਕ ਚੀਜ਼ ਹੈ ਲੋਕੀ ਘਰ ਬੈਠ ਕੇ ਵੀ ਪੈਸੇ ਕਮਾ ਸਕਦੇ ਹਨ ਜੋ ਸਾਨੂੰ ਬਹੁਤ ਸਹਾਇਤਾ ਕਰਦਾ ਹੈ ਪਰੰਤੂ ਸਾਨੂੰ ਇਸਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ ਅਗਰ ਆਪਾਂ ਸਹੀ ਉਪਯੋਗ ਕਰਾਂਗੇ ਤਾਂ ਹੀ ਸਾਨੂੰ ਇਹ ਮਦਦ ਕਰ ਸਕਦੀ ਅਗਰ ਆਪਾਂ ਇਸ ਚੀਜ਼ ਦਾ ਗਲਤ ਉਪਯੋਗ ਕਰਾਂਗੇ ਆਪਾਂ ਇਸ ਚੀਜ਼ ਦਾ ਉਪਯੋਗ ਕਿਸੇ ਨੂੰ ਥੱਲੇ ਗਿਰਾਣ ਵਾਸਤੇ ਕਰਨਗੇ ਤੇ ਸਾਨੂੰ ਉਹ ਸਹਾਇਤਾ ਨਹੀਂ ਦਏਗਾ ਉਹ ਸਾਡੇ ਲਈ ਬੁਰੀ ਚੀਜ਼ ਹੋਏਗੀ